ਪਹਿਲਾਂ ਤਾਂ ਆਪਣਾ ਪੰਜਾਬ ਦਾ ਹੀ ਹੈ ਪੰਜਾਬ ਦੇ ਵਿੱਚ ਗਿੱਦੜਾ ਗਿੱਧਾ ਅਤੇ ਭੰਗੜਾ ਬਹੁਤ ਮਸ਼ਹੂਰ ਆ ਹਰਿਆਣੇ ਦੇ ਵਿੱਚ ਹਰਿਆਣਾ ਲੋਕ ਨਾਚ ਆ ਅਤੇ ਮਹਾਰਾਸ਼ਟਰ ਦੇ ਵਿੱਚ ਵੀ ਮੈਂ ਮਸ਼ੀਨਾਂ ਮਸ਼ੂਨਾਂ ਲੈ ਕੇ ਜਾਂਦਾ ਰਿਹਾ ਉੱਥੇ ਵੀ ਦੇਖਿਆ ਉੱਥੇ ਮਰਾਠਾ ਨਾਚ ਨੱਚਦੇ ਆ ਉਹ ਆਪਣੀ ਆਪਣੇ ਸਟੇਟ ਦੀ ਭਾਸ਼ਾ ਦੇ ਵਿੱਚ ਦੇ ਦੇ ਅਨੁਸਾਰ ਨਾਚ ਕਰਦੇ ਆ ਗੁਜਰਾਤ ਦੇ ਵਿੱਚ ਅਲੱਗ ਆ ਅਲੱਗ ਅਲੱਗ ਹਰ ਇੱਕ ਸਟੇਟ ਦੇ ਵਿੱਚ ਆਪਣੀ ਜੋ ਉਹਨਾਂ ਦੀ ਮਾਤ ਬੋਲੀ ਹੁੰਦੀ ਆ ਉਸ ਭਾਸ਼ਾ ਵਿੱਚ ਉਹ ਨਾਚ ਕਰਦੇ ਆ ਅਤੇ ਬਾਕੀ ਰਿਹਾ ਡਾਂਸਰ ਡਾਂਸਰ ਤਾਂ ਜਿਵੇਂ ਹਰਿਆਣੇ ਦੀ ਸਪਨਾ ਚੌਧਰੀ ਮਸ਼ਹੂਰ ਆ ਦਿੱਲੀ ਦੇ ਵਿੱਚ ਕਈ ਡਾਂਸਰ ਮਸ਼ਹੂਰ ਨੇ ਮਹਾਰਾਸ਼ਟਰ ਦੇ ਵਿੱਚ ਵੀ ਮਸ਼ਹੂਰ ਨੇ ਡਾਂਸਰਜ਼